ਖੇਡਾਂ ਹਰੇਕ ਵਰਗ ਦੇ ਖੇਤਰ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ ਪਹਿਲੇ ਖੇਡਾਂ ਖੇਡਣ ਨਾਲ ਬੰਦਾ ਸਟਰੈਸ ਰਹਿਤ ਹੋ ਜਾਂਦਾ ਹਨ ਇਸ ਨਾਲ ਆਨੰਦ ਦਾਇਕ ਆਉਂਦੀ ਹੈ ਸਰੀਰ ਵਿੱਚ ਫੁਰਤੀ ਵੀ ਆਉਂਦੀ ਹਨ ਪਹਿਲੇ ਸਮੇਂ ਵਿੱਚ ਲੋਕ ਕਬੱਡੀ ਅਤੇ ਗੁੱਲੀ ਡੰਡਾ ਖੇਲਦੇ ਹੁੰਦੇ ਸਨ ਅਤੇ ਹੁਣ ਦੇ ਸਮੇਂ ਜਿਉਂ ਜਿਉਂ ਸਮਾਂ ਬਦਲਦਾ ਹੈ ਉਵੇਂ ਹੀ ਖੇਡਾਂ ਵੀ ਬਦਲ ਜਾਂਦੀਆਂ ਹਨ ਜਿੱਦਾਂ ਕਿ ਹੁਣ ਕ੍ਰਿਕਟ ਵਾਲੀਬਾਲ ਅਤੇ ਖੋ ਖੋ ਆ ਗਏ ਹਨ ਇਸ ਨਾਲ ਬੱਚਿਆਂ ਨੂੰ ਖੇਡਣ ਨਾਲ ਕਾਫੀ ਹੀ ਚੰਗਾ ਲੱਗਦਾ ਹੈ ਅਤੇ ਉਹ ਆਨੰਦ ਦਾਇਕ ਮਾਣਦੇ ਹਨ ਅਤੇ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਕੰਨੀ ਪ੍ਰੇਰਿਤ ਕਰੀਏ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਸਾਡੇ ਬੱਚੇ ਫ਼ੋਨ ਜਾਂ ਟੀਵੀ 'ਤੇ ਲੱਗੇ ਰਹਿੰਦੇ ਹਨ ਮਾਂ ਬਾਪ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਕੱਢ ਕੇ ਗਰਾਊਂਡ ਵੱਲ ਨੂੰ ਪ੍ਰੇਰਿਤ ਕਰੀਏ ਤਾਂ ਜੋ ਸਾਡੇ ਬੱਚਿਆਂ ਦੀ ਤੰਦਰੁਸਤੀ ਅਤੇ ਸਰੀਰਕ ਫੁਰਤੀ ਵਿੱਚ ਵਾਧਾ ਹੋਵੇ